ਹੈਲੋ ਦੀਦੀ ਮੈਂ ਕੋਚਿੰਗ ਸੈਂਟਰ 'ਚ ਲੱਗਣਾ ਹਾਂਜੀ ਪਲੱਸ ਟੂ ਕੀਤੀ ਹੋਈ ਹੈ ਮਾਨਸਾ 'ਚ ਕੋਈ ਸੈਂਟਰ ਹੈਗਾ ਤੁਸੀਂ ਕੀ ਕਰਦੇ ਹੋ ਉੱਥੇ ਬੱਚੇ ਕਿੰਨੇ ਨੇ ਉੱਥੇ ਮੈਡਮ ਦਾ ਸੁਭਾਉ ਕਿਵੇਂ ਹੈ ਤੁਸੀਂ ਕਿੰਨਾ ਟੈਮ ਲਾਇਆ ਸੀ ਉੱਥੇ ਤੁਹਾਡਾ ਹੋ ਗਿਆ ਕਲੀਅਰ ਫੀਸ ਕਿੰਨੀ ਹੈ ਜੀ ਹਾਂਜੀ ਫੀਸ ਕਿੰਨੀ ਹੈ ਘੱਟ ਕਰ ਲੈਣਗੇ ਕੁਛ ਅੱਛਾ ਜੀ ਨਹੀਂ ਨਹੀਂ ਜੀ ਠੀਕ ਹੈ ਜੀ ਜੀ ਤੁਸੀਂ ਮੈਨੂੰ ਅੱਗੇ ਮਿਲ ਜਿਓ ਠੀਕ ਹੈ ਦੀਦੀ ਮੈਂ ਕੱਲ੍ਹ ਤੋਂ ਸਟਾਰਟ ਕਰੂੰਗੀ

ਠੀਕ ਹੈ ਜੀ ਥੈਂਕ ਯੂ